ਹੈਲੋ ਮੈਂ ਮਿੰਤਰਾ ਤੋਂ ਬੋਲ ਰਹੀ ਹਾਂ ਕਸਟਮਰ ਕੇਅਰ ਫੋਨ ਨੰਬਰ 'ਤੇ ਮੈਂ ਕੌਲ ਕੀਤੀ ਹੈ ਅਤੇ ਮੇਰਾ ਮੇਰਾ ਨਾਮ ਹੀਨਾ ਸੈਨੀ ਹੈ ਮੇਰਾ ਓਰਡਰ ਨੰਬਰ ਹੈ ਟੂ ਟੂ ਜ਼ੀਰੋ ਜ਼ੀਰੋ ਵੰਨ ਨਾਈਨ ਏਟ ਮੈਂ ਤੁਹਾਨੂੰ ਓਰਡਰ ਕੀਤਾ ਸੀਗਾ ਕਿ ਜਿਹੜੀ ਮੇਰੀ ਬਲੈਕ ਕਲਰ ਦੀ ਕੁੜਤੀ ਹੈ ਉਸਨੂੰ ਸਮੇਂ ਸਿਰ ਪਹੁੰਚਾਇਆ ਜਾਵੇ ਤੁਸੀਂ ਮੈਨੂੰ ਹਫਤੇ ਦਾ ਟਾਈਮ ਦਿੱਤਾ ਸੀਗਾ ਅਤੇ ਦੋ ਦਿਨ ਬਾਅਦ ਮੈਂ ਮੈਰਿਜ 'ਤੇ ਜਾਣਾ ਹੈ ਅਤੇ ਉਹ ਜਿਹੜਾ ਉਸਦਾ ਟਰੈਕਿੰਗ ਹੈ ਉਸ ਨੂੰ ਮੈਂ ਡੇਲੀ ਬੇਸਿਸ 'ਤੇ ਚੈੱਕ ਕਰ ਰਹੀ ਹਾਂ ਉਸਦਾ ਜਿਹੜਾ ਟਰੈਕਿੰਗ ਹੈ ਕੋਈ ਸ਼ਿਪਮੈਂਟ ਨਹੀਂ ਹੋਈ ਹੈ ਓਰਡਰ ਦੀ ਕੁਝ ਵੀ ਨਹੀਂ ਹੋਈ ਹੈ ਅਤੇ ਮੈਨੂੰ ਉਹ ਕੁੜਤੀ ਬਹੁਤ ਵਧੀਆ ਲੱਗੀ ਸੀ ਅਤੇ ਮੈਨੂੰ ਇਹ ਸੀਗਾ ਕਿ ਉਹ ਕੁੜਤੀ ਹੈ ਉਹ ਆ ਜਾਵੇਗੀ ਤਾਂ ਸਮੇਂ ਸਿਰ ਅਤੇ ਮੈਂ ਉਸਨੂੰ ਮੈਰਿਜ 'ਤੇ ਆਪਣਾ ਪਾ ਸਕੂੰਗੀ ਪਰ ਤੁਸੀਂ ਉਸਦੀ ਸ਼ਿਪਮੈਂਟ ਹੀ ਨਹੀਂ ਹਾਲੇ ਤੱਕ ਕੀਤੀ ਹਾਲੇ ਉਸਨੂੰ ਪੈਕੇਜ ਨਹੀਂ ਕੀਤਾ ਤਾਂ ਹਾਲੇ ਕੁਛ ਵੀ ਉਹਦਾ ਜਿਹੜਾ ਟਰੈਕਿੰਗ ਹੈ ਉਸਨੂੰ ਮੈਂ ਲਗਾਤਾਰ ਚੈੱਕ ਕਰਦੀ ਰਹੀ ਉਸਦਾ ਟਰੈਕਿੰਗ ਬਿਲਕੁਲ ਵੀ ਕੁਝ ਨਹੀਂ ਹੋਇਆ ਤਾਂ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰਾ ਉਸ ਓਰਡਰ ਨੂੰ ਕੈਂਸਲ ਕਰ ਦਿੱਤਾ ਜਾਵੇ ਕਿਉਂਕਿ ਮੈਂ ਹੁਣ ਦੋ ਦਿਨ ਬਾਅਦ ਮੈਰਿਜ 'ਤੇ ਜਾਣਾ ਅਤੇ ਇਹ ਪੋਸੀਬਲ ਨਹੀਂ ਹੋ ਪਾਊਗਾ ਕਿ ਤੁਸੀਂ ਆਪਣੀ ਜਿਹੜੀ ਮੈਨੂੰ ਓਰਡਰ ਹੈ ਉਹ ਮੈਨੂੰ ਦੇ ਸਕੋ ਤਾਂ ਪਲੀਜ਼ ਮੈਂ ਇਹੀ ਰਿਕੁਐਸਟ ਕਰੂੰਗੀ ਕਿ ਮੇਰੇ ਓਰਡਰ ਨੂੰ ਕੈਂਸਲ ਕਰ ਦਿੱਤਾ ਜਾਵੇ ਕਿਉਂਕਿ ਉਹ ਸਮੇਂ ਸਿਰ ਨਹੀਂ ਪਹੁੰਚ ਰਹੀ ਹੈ ਅਤੇ ਤੁਸੀਂ ਉਸਦੀ ਸ਼ਿਪਮੈਂਟ ਬਹੁਤ ਲੇਟ ਕਰ ਦਿੱਤੀ ਹੈ